ਹੈਲੋ ਹਾਂਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਰਬੰਸ ਸਿੰਘ ਜੀ ਕੀ ਹਾਲ ਚਾਲ ਹੈ ਜੀ ਠੀਕ ਓਂ ਹਾਂਜੀ ਹਾਂਜੀ ਕਿਵੇਂ ਯਾਦ ਕਰਿਆ ਅੱਜ ਹਾਂਜੀ ਹਾਂਜੀ ਵੈਲਕਮ ਆਓ ਜੀ ਆਓ ਸਰਦੀ ਤਾਂ ਬਹੁਤ ਆ ਦੇਖੋ ਬਰਫ ਵੀ ਬਹੁਤ ਆ ਪਰ ਤੁਸੀਂ ਆ ਨਾ ਵੀ ਇੱਕ ਤਾਂ ਬੱਚਿਆਂ ਦੇ ਪੂਰੇ ਗਰਮ ਕੱਪੜੇ ਲੈ ਕੇ ਆਉਣੇ ਨੇ ਠੀਕ ਆ ਜੀ ਅਤੇ ਰਹਿਣ ਦੀ ਤਾਂ ਇੱਥੇ ਕੋਈ ਦਿੱਕਤ ਨਹੀਂ ਚਲੋ ਆਪਣੇ ਕੋਲ ਹੈਗਾ ਹੀ ਆ ਅਤੇ ਰਸਤੇ ਵਿੱਚ ਹਾਂਜੀ ਰਸਤੇ ਦੇ ਵਿੱਚ ਜੀ ਤੁਸੀਂ ਕੋਈ ਬਾਹਰਲਾ ਫੂਡ ਨਹੀਂ ਖਾਣਾ ਘਰ ਤੋਂ ਆਪਣਾ ਨਾਲ ਫੂਡ ਲੈ ਕੇ ਆ ਜਿਓ ਦਵਾਈ ਬੂਟੀ ਲੈ ਲਿਓ ਥੋੜ੍ਹੀ ਬਹੁਤੀ ਕਈ ਵਾਰ ਲੋੜ ਪੈ ਜਾਂਦੀ ਆ ਆਉਣਾ ਕਦੋਂ ਕੁ ਆ ਅੱਛਾ ਦੇਖੋ ਕੱਤੀ ਦਸੰਬਰ ਦੀ ਤਾਂ ਇੱਦਾਂ ਵੀਰੇ ਉਹਦਾ ਨਾ ਆਪਣਾ ਨਵਾਂ ਸਾਲ ਦੀ ਰਾਤ ਅਖੀਰਲਾ ਸਾਲ ਹੁੰਦਾ ਨਾ ਅਤੇ ਰਸ਼ ਬਹੁਤ ਹੁੰਦਾ ਅਤੇ ਰਸ਼ ਹੋਣ ਕਰਕੇ ਨਾ ਤੁਸੀਂ ਜੇ ਹੋ ਸਕਿਆ ਤਾਂ ਪਹਿਲਾਂ ਟਰਾਈ ਕਰ ਲਓ ਵੀ ਦੋ ਕ ਦਿਨ ਪਹਿਲਾਂ ਆ ਜੋ ਨਹੀਂ ਨਾ ਰੋਡ ਜਾਮ ਹੋ ਜਾਂਦੇ ਨੇ ਬਿਲਕੁਲ ਨਿਕਲਣ ਦੀ ਦਿੱਕਤ ਆ ਜਾਣੀ ਆ ਜੇ ਹੋ ਸਕਿਆ ਤਾਂ ਇੱਕ ਦੋ ਦਿਨ ਪਹਿਲਾਂ ਦੀ ਟਰਾਈ ਕਰ ਲਿਓ ਵੀ ਆ ਪਹੁੰਚ ਦੀ ਕੋਸ਼ਿਸ਼ ਕਰ ਲਿਓ ਪਾਰਕਿੰਗ ਵਾਲੀ ਜਿਹੜੀ ਗੱਲ ਉਹ ਤਾਂ ਕੋਈ ਚੱਕਰ ਨਹੀਂ ਤਾਂ ਆਪਾਂ ਨੂੰ ਚਲੋ ਹੈਗਾ ਹੀ ਆ ਰਿਹਾਇਸ਼ ਆ ਆਪਣੀ ਉਰੇ ਹਾਂਜੀ ਹਾਂਜੀ ਹੋਰ ਬ ਹਾਂਜੀ ਹਾਂਜੀ ਉਹ ਜ਼ਰੂਰੀ ਆ ਨਾ ਫਿਰ ਬਿਲਕੁਲ ਏ ਬਹੁਤ ਲੰਬੇ ਲੰਬੇ ਉਹ ਹੋ ਜਾਂਦੇ ਨੇ ਜਾਮ ਲੱਗ ਜਾਂਦੇ ਨੇ ਹੋਰ ਬੱਚਿਆਂ ਦਾ ਕੀ ਹਾਲ ਚਾਲ ਆ

ਓਕੇ ਬਾਕੀ ਘੁੰਮਣ ਦੇ ਕੋਈ ਟੈਂਸ਼ਨ ਨਹੀਂ ਲੈਣੀ ਹੈਗੀ ਘੁੰਮਣ ਨੂੰ ਉਰੇ ਬਹੁਤ ਕੁਛ ਆ ਜਿਵੇਂ ਹਿਮਾਚਲ ਆ ਜੰਮੂ ਆ ਉੱਪਰ ਆਪਾਂ ਕੁਫਰੀ ਜਾ ਸਕਦੇ ਹਾਂ ਠੀਕ ਆ ਨਾ ਹੋਰ ਇੱਥੇ ਲੋਕਲ ਇਕੱਤੀ ਦਿਸੰਬਰ ਨੂੰ ਬਹੁਤ ਪ੍ਰੋਗਰਾਮ ਹੁੰਦੇ ਨੇ ਵਧੀਆ ਵਧੀਆ ਉਹ ਸਾਰਾ ਕੁਛ ਵਧੀਆ ਉਰੇ ਇਹੋ ਜਿਹੀ ਕੋਈ ਚੱਕਰ ਨਹੀਂ ਹੈਗਾ ਆਜੋ ਤੁਸੀਂ ਜਦੋਂ ਵੀ ਆਉਣਾ ਅੱਛਾ ਅੱਛਾ

ਚਲੋ ਕੋਈ ਕੋਈ ਗੱਲ ਏ ਨਹੀਂ ਵੀਰੇ ਕੋਈ ਗੱਲ ਨਹੀਂ ਘਬਰਾਉਣਾ ਨਹੀਂ ਹੈਗਾ ਜਦੋਂ ਵੀ ਆਉਣਾ ਮੋਸਟ ਵੈਲਕਮ ਆ ਓਕੇ ਓਕੇ